ਜਦੋਂ ਯੋਗਾ ਤੁਹਾਡੀ ਨੀਂਦ ਦੇ ਪੈਟਰਕ ਜਾਂ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਕਿਸੇ ਤਰੀਕੇ ਨਾਲ ਅਤੇ ਕਿਉਂ ਹੋ ਰਿਹਾ ਹੈ ਯੋਗਾ ਇੱਕ ਪ੍ਰਾਚੀਨ ਵਿਗਿਆਨਿਕ ਅਤੇ ਅਧਿਆਤਮਿਕ ਵਿਧੀ ਹੈ ਜੋ ਨਾ ਸਿਰਫ਼ ਸਰੀਰਿਕ ਤੰਦਰੁਸਤੀ ਸਗੋਂ ਮਾਨਸਿਕ ਸ਼ਾਂਤੀ ਅਤੇ ਅਧਿਆਤਮਿਕ ਸੰਤੁਲਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਯੋਗਾ ਦੀਆਂ ਵੱਖ ਵੱਖ ਵਿਧੀਆਂ ਜਿਵੇਂ ਕਿ ਆਸਨ ਪ੍ਰਾਣਾਯਾਮ ਧਿਆਨ ਅਤੇ ਸ਼ੀਸ਼ ਆਰਾਮ ਦੀ ਵਿਧੀ ਮਨੁੱਖ ਦੀ ਨੀਂਦ ਦੀ ਗੁਣਵੱਤਾ ਨੂੰ ਸੁਧਾਰ ਸਕਦੀਆਂ ਹਨ ਅਨੁਭਵ ਅਤੇ ਵਿਗਿਆਨਿਕ ਅਧਿਐਨ ਦੱਸਦੇ ਹਨ ਕਿ ਯੋਗਾ ਕਰਨ ਨਾਲ ਨਰਵਸ ਸਿਸਟਮ ਸ਼ਾਂਤ ਹੁੰਦਾ ਹੈ ਧਿਆਨ ਘੱਟਦਾ ਹੈ ਅਤੇ ਕਾਰਿਟ ਸੋਲ ਦੀ ਮਾਤ ਕ੍ਰੈਸਟੋਲ ਦੀ ਮਾਤਰਾ ਕਮ ਹੁੰਦੀ ਹੈ ਜਿਸ ਕਰਕੇ ਸਰੀਰ ਅਤੇ ਮਨ ਅਰਾਮ ਦੀ ਹਾਲਤ ਵਿੱਚ ਆ ਜਾਂਦਾ ਹਨ ਇਹ ਸੰਕਲਪ ਵਿਗਿਆਨਿਕ ਤੌਰ 'ਤੇ ਵੀ ਸਾਬਤ ਹੋਇਆ ਹੈ ਕਿ ਯੋਗਾ ਦੀਆਂ ਨਿੱਜੀ ਕਸਰਤਾ ਮਨੁੱਖਾਂ ਦੇ ਪੈਰਾਂ ਸਿਪਸਥੈਟਿਕ ਨਵਸ ਸਿਸਟਮ ਨੂੰ ਐਕਟੀਵੇਟ ਕਰਦੀਆਂ ਹਨ ਜਿਸ ਨਾਲ ਮਨ ਮਸਤਕ 'ਚ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਸਰੀਰ ਆਰਾਮ ਦੀ ਹਾਲਤ ਵਿੱਚ ਚਲਦਾ ਜਾਂਦਾ ਹੈ ਜੋ ਕਿ ਨੀਂਦ ਲਈ ਬਹੁਤ ਜ਼ਰੂਰੀ ਹੁੰਦਾ ਹੈ ਨੀਂਦ ਉੱਤੇ ਵੀ ਯੋਗਾ ਦਾ ਬਹੁਤ ਚੰਗਾ ਪ੍ਰਭਾਵ ਦੇਖ ਸਕਦੇ ਹਾਂ ਕੀ ਯੋਗਾ ਨਾਲ ਕਰਨ ਨਾਲ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਆਉਂਦਾ ਹੈ ਜਿਨਾਂ ਲੋਕਾਂ ਨੂੰ ਨੀਂਦ ਦੀ ਸਮੱਸਿਆ ਰਹਿੰਦੀ ਹੈ ਉਹ ਯੋਗਾ ਦੀਆਂ ਕੁਝ ਖ਼ਾਸ ਵਿਧੀਆਂ ਜਿਵੇਂ ਕਿ ਸਵਾਸ ਆਸਨ ਬਲਆਸਨ ਵਿਪ੍ਰੀਤ ਕਰਨੀ ਸਵਾਸ ਪ੍ਰਾਣਾਯਾਮ ਨੂੰ ਆਪਣੀ ਰੋਜ਼ਾਨਾ ਜੀਵਨ ਵਿੱਚ ਸ਼ਾਮਿਲ ਕਰਕੇ ਇਸ ਸਮੱਸਿਆ ਨੂੰ ਘਟਾ ਸਕਦੇ ਹਨ ਯੋਗਾ ਰਾਤ ਨੂੰ ਰਾਤ ਨੂੰ ਮਨ ਮਸਤਕ ਵਿੱਚ ਚੱਲ ਰਹੀਆਂ ਉਲਝਨਾਂ ਫਿਕਰ ਫਿਕਰਾਂ ਅਤੇ ਦਿਨ ਭਰ ਦੀ ਥਕਾਵਟ ਨੂੰ ਦੂਰ ਕਰਕੇ ਮਨ ਨੂੰ ਸ਼ਾਂਤ ਕਰਦਾ ਹੈ ਜਿਸ ਕਰਕੇ ਨੀਂਦ ਆਸਾਨੀ ਨਾਲ ਆਉਂਦੀ ਹੈ ਖਾਸ ਤੌਰ 'ਤੇ ਜੇਕਰ ਕੋਈ ਵਿਅਕਤੀ ਲੰਬੇ ਸਮੇਂ ਤੱਕ ਧਿਆਨ ਡਿਪਰੈਸ਼ਨ ਜਾਂ ਚਿੰਤਾ ਨਾਲ ਜੂਝ ਰਿਹਾ ਹੈ ਤਾਂ ਤਾਂ ਯੋਗਾ ਉਸਨੂੰ ਧਿਆਨ ਤੋਂ ਘਟਾ ਸਕਦਾ ਹੈ ਜਿਸ ਨਾਲ ਅਰਾਮਦਾਇਕ ਅਤੇ ਡੀਪ ਸਲੀਪ ਯਾਨੀ ਕਿ ਗਹਿਰੀ ਨੀਂਦ ਪ੍ਰਾਪਤ ਕਰ ਸਕਦੇ ਹਾਂ